ਕਿਸੇ ਕਿਤਾਬ ਵਿੱਚੋਂ ਮੇਰਾ ਮਨਪਸੰਦ ਵੈਸੇ ਜਿਹੜੀ ਮੇਰੀ ਫੇਵਰੇਟ ਕਿਤਾਬ ਹੈ ਉਹ ਹੈਗੀ ਆ ਲਾਈਫ ਇਜ਼ ਵਟ ਯੂ ਮੇਕ ਇੱਟ ਤਾਂ ਉਹਦੇ ਵਿੱਚੋਂ ਮੈਨੂੰ ਸਭ ਤੋਂ ਵਧੀਆ ਇਹ ਚੀਜ਼ ਲੱਗਦੀ ਹੈ ਕਿ ਤੁਸੀਂ ਜਿਸ ਤਰ੍ਹਾਂ ਚਾਹੋ ਆਪਣੀ ਲਾਈਫ ਨੂੰ ਬਣਾ ਸਕਦੇ ਹੋ ਇਹ ਮੇਰੇ ਨਾਲ ਕਿਉਂ ਰਿਲੇਟ ਕਰਦਾ ਉਹ ਇਸ ਕਰਕੇ ਕਿਉਂਕਿ ਮੈਨੂੰ ਲੱਗਦਾ ਕਿ ਇੱਕ ਪਰਸਨ ਜਿਹੜਾ ਹੁੰਦਾ ਉਹ ਆਪਣੇ ਅਕੋਡਿੰਗ ਆਪਣੀ ਲਾਈਫ ਨੂੰ ਬਣਾ ਵੀ ਸਕਦਾ ਅਤੇ ਸਵਾਰ ਵੀ ਸਕਦਾ ਅਤੇ ਵਿਗਾੜ ਵੀ ਸਕਦਾ ਹੁਣ ਸਵਾਰਨ ਦੇ ਵਿੱਚ ਕੰਨਸੈਪਟ ਇਹ ਹੈ ਕਿ ਤੁਸੀਂ ਜੇ ਚਾਹੁੰਦੇ ਹੋ ਕਿ ਤੁਹਾਡੀ ਲਾਈਫ ਜਿਹੜੀ ਹੈ ਉਹ ਹੈਪੀ ਹੋਵੇ ਸਮੂਦ ਹੋਵੇ ਤਾਂ ਫਿਰ ਤੁਸੀਂ ਉਸ ਦੇ ਲਈ ਮਿਹਨਤ ਕਰਦੇ ਹੁੰਦੇ ਹੋ ਪੜ੍ਹਾਈ ਕਰਦੇ ਹੋ ਫਿਰ ਜੋਬ ਲੈਂਦੇ ਹੋ ਜੋਬ ਲੈ ਕੇ ਫਿਰ ਆਪਣੀ ਲਾਈਫ ਨੂੰ ਸੈਟਲ ਡਾਊਨ ਕਰਦੇ ਹੋ ਅਤੇ ਜ਼ਿੰਮੇਵਾਰੀਆਂ ਦਾ ਅਹਿਸਾਸ ਹੁੰਦਾ ਤੁਹਾਨੂੰ ਜ਼ਿੰਮੇਵਾਰੀਆਂ ਦਾ ਅਹਿਸਾਸ ਹੋ ਕੇ ਵੀ ਤੁਸੀਂ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਵੀ ਪੂਰੀਆਂ ਕਰਦੇ ਹੋ ਔਫਿਸ ਦੀਆਂ ਵੀ ਕਰਦੇ ਬਟ ਅਗਰ ਤੁਸੀਂ ਦੇਖੋ ਕਿ ਵਿਗਾੜਨ ਵਾਲੀ ਗੱਲ ਜਿਹੜੀ ਹੈ ਉਹ ਤੁਸੀਂ ਆਪਣੀ ਲਾਈਫ ਨੂੰ ਜਿੱਦਾਂ ਮਰਜੀ ਵਿਗਾੜ ਸਕਦੇ ਹੋ ਸਾਰਾ ਦਿਨ ਫੋਨ ਦੇਖੀ ਜਾਓ ਸੁੱਤੇ ਰਹੋ ਇੱਧਰ ਘੁੰਮ ਲਿਆ ਲੋਕਾਂ ਦੇ ਨਾਲ ਉੱਧਰ ਘੁੰਮ ਲਿਆ ਯਾਰਾਂ ਦੋਸਤਾਂ ਦੇ ਨਾਲ ਤਾਂ ਇਸ ਕਰਕੇ ਮੈਨੂੰ ਉਹ ਕਿਤਾਬ ਜਿਹੜੀ ਬੜੀ ਵਧੀਆ ਲੱਗਦੀ ਹੈ ਕਿ ਲਾਈਫ ਇਜ਼ ਵਟ ਯੂ ਮੇਕ ਇੱਟ ਕਿ ਜਿੱਦਾਂ ਵੀ ਤੁਸੀਂ ਆਪਣੀ ਲਾਈਫ ਨੂੰ ਚਾਹੋ ਉੱਦਾਂ ਦਾ ਤੁਸੀਂ ਬਣਾ ਸਕਦੇ ਹੋ ਆਪਣੇ ਪਰਸਪੈਕਟਸ ਦੇ ਅਕੋਡਿੰਗਲੀ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਲਾਈਫ ਵਧੀਆ ਹੋਵੇ ਤਾਂ ਤੁਸੀਂ ਆਪਣੇ ਲਾਈਫ ਨੂੰ ਇੱਕ ਚੰਗੀ ਸੇਧ ਦੇ ਸਕਦੇ ਹੋ ਚੰਗੇ ਥੋਟਸ ਦੇ ਨਾਲ ਚੰਗੇ ਪ੍ਰੋਸੈਸਿਸ ਦੇ ਨਾਲ ਚੰਗੀਆਂ ਕਿਤਾਬਾਂ ਪੜ੍ਹ ਕੇ ਉਹਨਾਂ 'ਚੋਂ ਚੰਗੀਆਂ ਚੰਗੀਆਂ ਚੀਜ਼ਾਂ ਸਿੱਖ ਕੇ